ਜਦੋਂ ਅਸੀਂ ਰਸੋਈ ਵਿੱਚ ਖਾਣਾ ਬਣਾਉਂਦੇ ਹਾਂ ਜਾਂ ਕੰਮ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਡਾ ਧਿਆਨ ਰਸੋਈ ਅਤੇ ਆਪਣੀ ਸਵੱਛਤਾ ਵੱਲ ਜਾਂਦਾ ਹੈ ਰਸੋਈ ਵਿੱਚ ਕੰਮ ਕਰਨ ਵੇਲੇ ਸਾਨੂੰ ਆਪਣੇ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਸਾਫ਼ ਕਰਨੇ ਚਾਹੀਦੇ ਹੈ ਅਤੇ ਡਿਟੋਲ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਸਾਡੇ ਹੱਥਾਂ ਵਿੱਚ ਲੱਗੇ ਕੀਟਾਣੂ ਸਾਡੇ ਸਰੀਰ ਦੇ ਅੰਦਰ ਨਾ ਜਾਣ ਅਤੇ ਭੋਜਨ ਖਾਣ ਵੇਲੇ ਵੀ ਬਿਮਾਰ ਨਾ ਹੋਣ ਦੂਜੀ ਸਾਵਧਾਨੀ ਇਹ ਹੈ ਕਿ ਸਾਨੂੰ ਰਸੋਈ ਵਿੱਚ ਕੰਮ ਕਰਨ ਵੇਲੇ ਸੂਤੀ ਕੱਪੜੇ ਪਾਉਣੇ ਚਾਹੀਦੇ ਹੈ ਸੂਤੀ ਕੱਪੜੇ ਰਸੋਈ ਵਿੱਚ ਲਾਭਦਾਇਕ ਹੁੰਦੇ ਹਨ ਸੂਤੀ ਕੱਪੜੇ ਪਾਉਣ ਵੇਲੇ ਸੂਤੀ ਕੱਪੜੇ ਪਾ ਕੇ ਰਸੋਈ ਵਿੱਚ ਕੰਮ ਕਰਨ ਨਾਲ ਅੱਗ ਸਾਨੂੰ ਨਹੀ ਫੜ੍ਹਦੀ ਨਾ ਹੀ ਅੱਗ ਦਾ ਕੋਈ ਨੁਕਸਾਨ ਹੁੰਦਾ ਹੈ ਰਸੋਈ ਵਿੱਚ ਕੰਮ ਕਰਨ ਵੇਲੇ ਸਬਜ਼ੀ ਨੂੰ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ ਸਬਜ਼ੀ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖਣਾ ਚਾਹੀਦਾ ਹੈ ਤਾਂ ਜੋ ਸਾਨੂੰ ਸਬਜ਼ੀ ਢੱਕ ਕੇ ਰੱਖਣ ਨਾਲ ਕੀਟਾਣੂ ਸਾਡੇ ਅੰਦਰ ਨਾ ਜਾ ਸਕਣ ਕੀਟਾਣੂ ਸਬਜ਼ੀ ਵਿੱਚ ਪੈਣ ਦਾ ਡਰ ਵੀ ਨਹੀਂ ਰਹਿੰਦਾ ਤਾਂ ਜੋ ਭੋਜਨ ਨਾ ਖਰਾਬ ਹੋ ਸਕੇ ਸਬਜ਼ੀ ਨੂੰ ਚੰਗੀ ਤਰ੍ਹਾਂ ਪਕਾਉਣਾ ਚਾਹੀਦਾ ਹੈ ਤਾਂ ਜੋ ਉਸ ਸਬਜ਼ੀ ਪੱਕ ਕੇ ਢੱਕ ਕੇ ਕੀਟਾਣੂਆਂ ਦਾ ਖਾਤਮਾ ਕਰ ਦਵੇ